ਪੰਜਾਬ ਸੋਨੇ ਦੀ ਚਿੜੀ ਹੋਣ ਦੇ ਨਾਲ ਨਾਲ ਇਸ ਦੀਆਂ ਕੁਝ ਮਸ਼ਹੂਰ ਚੀਜ਼ਾਂ ਹਨ ਜਿਵੇਂ ਕਿ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਨਾਲ ਲੱਸੀ ਜੋ ਕਿ ਪੰਜਾਬੀਆਂ ਨੂੰ ਬਹੁਤ ਪਸੰਦ ਹੈ ਅਤੇ ਅਜੋਕੇ ਸਮਾਜ ਵਿੱਚ ਹੀ ਪੰਜਾਬੀ ਇਸ ਨੂੰ ਖਾਂਦੇ ਸਨ ਅਤੇ ਦੂਰ ਦੁਰਾਡੇ ਦੇ ਲੋਕਾਂ ਅ ਜ਼ਿਆਦਾ ਪੰਜਾਬ ਵਿੱਚ ਆਉਂਦੇ ਹਨ ਅਤੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਵੀ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਈਏ ਤਾਂ ਅਤੇ ਪੰਜਾਬੀ ਇਹ ਸਭ ਪਕਵਾ ਪਕਾਉਂਦੇ ਹਨ ਉਹਨਾਂ ਲਈ ਅਤੇ ਵਧਦੇ ਸਮੇਂ ਨਾਲ ਇਸ ਦੀਆਂ ਚੀਜ਼ਾਂ ਚੇਂਜ ਹੋ ਰਹੀਆਂ ਹਨ ਜਿਵੇਂ ਕਿ ਅੱਜ ਕੱਲ੍ਹ ਦਾ ਕੁਲਚਾ ਬਰਗਰ ਹੋ ਗਏ ਇਹ ਵੀ ਪੰਜਾਬੀ ਖਾਣ ਲੱਗ ਗਏ ਹਨ ਨਾਲ ਨਾਲ ਜਲੇਬੀਆਂ ਵੀ ਪੰਜਾਬੀ ਦੀਆਂ ਪੰਜਾਬੀਆਂ ਦੀਆਂ ਮਨ ਪਸੰਦ ਹਨ ਅਤੇ ਮਿੱਠੇ ਬਿਨਾਂ ਤਾਂ ਪੰਜਾਬੀ ਬਿਲਕੁਲ ਨਹੀਂ ਸਾਰਦੇ ਅਤੇ ਮੇਲਿਆਂ ਦੇ ਵਿੱਚ ਜਲੇਬੀਆਂ ਅਤੇ ਪਕੌੜੇ ਪੰਜਾਬੀਆਂ ਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਪੰਜਾਬੀਆਂ ਦੀ ਫੇਵਰੇਟ ਲੱਸੀ ਹੈ ਅਤੇ ਜਿਸ ਬਿਨਾਂ ਤਾਂ ਉਹ ਰੋਟੀ ਹੀ ਨਹੀਂ ਖਾਂਦੇ